ਵੈਸੇ ਤਾਂ ਘਰ ਦੀ ਸਫਾਈ ਆਪਾਂ ਰੋਜ਼ਾਨਾ ਅਤੇ ਡੇਲੀ ਓ ਕਰਦੇ ਹਾਂ ਅਤੇ ਤਿਉਹਾਰ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਘਰ ਦੀ ਸਫਾਈ ਚੰਗੀ ਤਰ੍ਹਾਂ ਕਰ ਲੈਂਦੇ ਹਾਂ ਅਤੇ ਜੋ ਗਊ ਮਾਤਰ ਜਿਸ ਨੂੰ ਗੋਹਾ ਕਹਿੰਦੇ ਆ ਇਹ ਆਪਣੇ ਘਰ ਵਿੱਚ ਲਿਪਣ ਦੇ ਅਤੇ ਪਾਥਾ ਪੱਥਣੀਆਂ ਦੇ ਅਤੇ ਜਾਂ ਹੋਰ ਕਈ ਚੀਜ਼ਾਂ 'ਚ ਕੰਮ ਆਉਂਦਾ ਹੈ ਅਤੇ ਇਸ ਨੂੰ ਲਿਪਣ ਨਾਲ ਘਰ ਵਿੱਚ ਕੀਟਾਣੂ ਕੀੜਾ ਮਕੌੜਾ ਚੂਹੇ ਆਦਿ ਨਹੀਂ ਆਉਂਦੇ ਹਨ ਇਸ ਕਰਕੇ ਇਸ ਦੀ ਘਰ ਵਿੱਚ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਹ ਵਿਆਹਾਂ ਸ਼ਾਦੀਆਂ ਵਿੱਚ ਬਹੁਤਾ ਵਰਤਿਆ ਜਾਂਦਾ ਹੈ ਇਸ ਨਾਲ ਘਰ ਦੀ ਲਿਪ ਲਪਈਆ ਅਤੇ ਚੁੱਲ੍ਹੇ ਅਤੇ ਆਦਿ ਵਿੱਚ ਬਹੁਤ ਚੀਜ਼ਾਂ ਵਿੱਚ ਵਰਤਿਆ ਜਾਂਦਾ ਹੈ ਅਤੇ ਇਹ ਘਰ ਵਿੱਚ ਸਫਾਈ ਕਰਨ ਦੇ ਕੰਮ ਵਿੱਚ ਬਹੁਤ ਜ਼ਿਆਦਾਤਰ ਕੰਮ ਆਉਂਦਾ ਹੈ ਅਤੇੇ ਕੰਮ ਕਰਨ ਵਿੱਚ ਵਰਤਿਆ ਜਾਂਦਾ ਹੈ ਇਸ ਲਈ ਇਸ ਨੂੰ ਘਰ ਵਿੱਚ ਕਈ ਤਰ੍ਹਾਂ ਦੀਆਂ ਆਈਟਮਾਂ ਵਿੱਚ ਵੀ ਵਰਤਿਆ ਜਾਂਦਾ ਹੈ